ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਜਿਹਨਾਂ ਵਿੱਚੋਂ ਸਾਡੇ ਪੰਜਾਬ ਜ਼ਿਲ੍ਹੇ ਵਿੱਚ ਇੱਕ ਪ੍ਰਮੁੱਖ ਜ਼ਿਲ੍ਹਾ ਹੈ ਪਠਾਨਕੋਟ ਅਸੀਂ ਪਠਾਨਕੋਟ ਵਿੱਚ ਰਹਿੰਦੇ ਹਾਂ ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਹਨਾਂ ਵਿੱਚੋਂ ਦੀਵਾਲੀ ਦੁਸਹਿਰਾ ਹੋਲੀ ਇਹ ਸਾਰੇ ਤਿਉਹਾਰ ਅਸੀਂ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਹਾਂ ਇਹਨਾਂ ਵਿੱਚੋਂ ਅਸੀਂ ਦੀਵਾਲੀ ਦਾ ਤਿਉਹਾਰ ਤੁਹਾਨੂੰ ਦੱਸਦੇ ਹਾਂ ਵੀ ਅਸੀਂ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਦੀਵਾਲੀ ਹਿੰਦੂਆਂ ਦਾ ਪ੍ਰਸਿੱਧ ਤਿਉਹਾਰ ਹੈ ਇਹ ਕੱਤਕ ਦੀ ਅਮਾਵੱਸਿਆ ਨੂੰ ਮਨਾਇਆ ਜਾਂਦਾ ਹੈ ਇਹ ਦਿਵਸ ਦੁਸਹਿਰੇ ਦੇ ਵੀਹ ਦਿਨ ਬਾਅਦ ਆਉਂਦਾ ਹੈ ਜਦੋਂ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤਾਂ ਅਸੀਂ ਆਪਣੇ ਘਰਾਂ ਦੀ ਲੀਪਾਈ ਪੁਤਾਈ ਬੜੀ ਅੱਛੀ ਤਰ੍ਹਾਂ ਕਰਦੇ ਹਾਂ ਅਤੇ ਆਪਣੇ ਘਰ ਨੂੰ ਬਹੁਤ ਹੀ ਅੱਛੀ ਤਰ੍ਹਾਂ ਸਜਾਉਂਦੇ ਹਾਂ ਤਾਂ ਕਿ ਕਹਿੰਦੇ ਹਨ ਕਿ ਲਕਸ਼ਮੀ ਮਾਤਾ ਇਸ ਦਿਨ ਹ ਹਰ ਘਰ ਫੇਰਾ ਪਾਉਂਦੀ ਹੈ ਜਿਸ ਦਿਨ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਉਸ ਦਿਨ ਅਸੀਂ ਆਪਣੇ ਬੱਚਿਆਂ ਨੂੰ ਨਵੇਂ ਨਵੇਂ ਕੱਪੜੇ ਪਹਿਨਾ ਕੇ ਉਹਨਾਂ ਨੂੰ ਬਾਜ਼ਾਰ ਲੈ ਕੇ ਜਾਂਦੇ ਹਾਂ ਉੱਥੋਂ ਅਸੀਂ ਸ ਕਾਫੀ ਸਾਰੇ ਸਮਾਨ ਲੈ ਕੇ ਆਪਣੇ ਘਰ ਨੂੰ ਆਉਂਦੇ ਹਾਂ ਅਤੇ ਅਸੀਂ ਘਰ ਆ ਕੇ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਾਂ ਲਕਸ਼ਮੀ ਮਾਤਾ ਦੀ ਪੂਜਾ ਕਰਨ ਤੋਂ ਬਾਅਦ ਅਸੀਂ ਖੂਬ ਸਾਰੀਆਂ ਮਿਠਾਈਆਂ ਦਾ ਭੋਗਉਂਦੇ ਹਾਂ ਅਤੇ ਆਪਣੇ ਘਰ ਅੱਛੇ ਅੱਛੇ ਪਕਵਾਨ ਵੀ ਬਣਾਉਂਦੇ ਹਾਂ ਜਦੋਂ ਅਸੀਂ ਆਪਣੇ ਘਰ ਪਕਵਾਨ ਬਣਾਉਂਦੇ ਹਾਂ ਅਤੇ ਅਸੀਂ ਸਾਰਾ ਪਰਿਵਾਰ ਬੈਠ ਕੇ ਉਸ ਪਕਵਾਨ ਨੂੰ ਬੜੇ ਹੀ ਚਾਅ ਅਤੇ ਮਜ਼ੇ ਨਾਲ ਖਾਂਦੇ ਹਾਂ ਸਾਨੂੰ ਦੀਵਾਲੀ ਦਾ ਤਿਉਹਾਰ ਬੜਾ ਹੀ ਚੰਗਾ ਲੱਗਦਾ ਹੈ ਜਦੋਂ ਬੱਚੇ ਖਾਣਾ ਖਾ ਲੈਂਦੇ ਹਨ ਤਾਂ ਉਸ ਤੋਂ ਬਾਅਦ ਬੱਚੇ ਪਟਾਕੇ ਆਦਿ ਚਲਾਉਣ ਦੀ ਜਿੱਦ ਕਰਦੇ ਹਨ ਅਤੇ ਅਸੀਂ ਉਹਨਾਂ ਨੂੰ ਪਟਾਕੇ ਚਲਾਉਣ ਲਈ ਬਹੁਤ ਹੀ ਚੰਗੀ 'ਚ ਖੁੱਲ੍ਹੀ ਜਗ੍ਹਾ 'ਤੇ ਲੈ ਜਾਂਦੇ ਹਾਂ ਅਤੇ ਅਸੀਂ ਖੂਬ ਸਾਰੇ ਪਟਾਕੇ ਚਲਾਉਂਦੇ ਹਾਂ ਅਤੇ ਬੱਚੇ ਬੜੇ ਹੀ ਖੁਸ਼ ਹੋ ਜਾਂਦੇ ਹਨ ਅਤੇ ਅਸੀਂ ਇਹ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਹਾਂ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਅਸੀਂ ਹੋਰ ਵੀ ਕਈ ਸਾਰੇ ਕੰਮ ਕਰਦੇ ਹਾਂ ਜਿਸ ਵਿੱਚ ਦੀਵਾਲੀ ਬੜਾ ਹੀ ਸੋਹਣਾ ਅਤੇ ਚਾਅਵਾਂ ਭਰਿਆ ਤਿਉਹਾਰ ਆਉਂਦਾ ਹੈ